ਹੈਲੋ ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਚਾਲ ਤੁਹਾਡਾ ਮੈਂ ਨਾ ਤੁਹਾਡੇ ਗੁਆਂਡ 'ਚ ਆਈ ਆ ਇੱਕ ਦੋ ਦਿਨ ਹੀ ਹੋਏ ਹਲੇ ਆਈ ਨੂੰ ਅਤੇ ਹਾਂਜੀ ਹਾਂਜੀ ਹਾਂਜੀ ਉਹੀ ਉਹੀ ਬਸ ਠੀਕ ਆ ਤੁਸੀਂ ਦੱਸੋ ਤੁਸੀਂ ਠੀਕ ਬਸ ਵਧੀਆ ਮੈਮ ਮੈਨੂੰ ਨਾ ਤੁਹਾਡੀ ਮਦਦ ਚਾਹੀਦੀ ਸੀ ਇੱਕ ਮੈ ਇੱਥੋਂ ਦੀ ਮਾਰਕੀਟ ਬਾਰੇ ਨਹੀਂ ਕੁਛ ਪਤਾ ਮੈਂ ਸਬਜ਼ੀ ਲੈਣੀ ਆ ਕੱਲ੍ਹ ਗਲੀ 'ਚੋਂ ਲਿਤੀ ਉਹ ਬੜੀ ਗੰਦੀ ਸਬਜ਼ੀ ਸੀ ਤਾਂ ਤੁਸੀਂ ਦੱਸੋ ਕਿੱਥੇ ਵਧੀਆ ਇਹਦੀ ਹੈ ਮਾਰਕੀਟ

ਅੱਛਾ

ਹਾਂਜੀ ਜੀ ਅੱਛਾ ਅੱਛਾ ਹਾਂ ਹਾਂ ਉਹ ਤਾਂ ਹੈ ਚੱਲ ਮੈਂ ਜਾਵਾਂਗੀ ਮੈਂ ਦੇਖਾਂਗੀ ਨਹੀਂ ਨਹੀਂ ਕੋਈ ਨਹੀਂ ਮੈਂ ਆਪੇ ਵੇ ਦੇਖਦੀ ਹਾਂ ਅੱਜ ਜਾਂਦੀ ਹਾਂ ਬਾਹਰ ਹਾਂ ਜ਼ਰੂਰ ਜ਼ਰੂਰ ਤੁਹਾਨੂੰ ਹੀ ਦੱਸਣਾ ਠੀਕ ਆ ਓਕੇ